ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਅੱਛਾ ਜੀ ਸੂਟਾ ਵਾਸਤੇ ਹਾਂਜੀ ਮੈਡਮ ਫਿਰ ਤੁਸੀਂ ਆ ਜਾਓ ਜਦੋਂ ਮਰਜ਼ੀ ਹਾਂਜੀ ਹਾਂਜੀ ਹਾਂਜੀ ਮੈਡਮ ਅਤੇ ਬਹੁਤ ਵਧੀਆ ਜਗ੍ਹਾ ਤੁਸੀਂ ਚੁਣੀ ਆ ਇੱਥੇ ਹਰ ਵਰਾਇਟੀ ਦਾ ਤੁਹਾਨੂੰ ਕੱਪੜਾ ਮਿਲੂਗਾ ਸੂਟ ਵੀ ਅਤੇ ਸਾੜੀਆਂ ਵੀ ਤੁਸੀਂ ਆਪਣੀ ਚੋਇਸ ਦੱਸੋ ਤੁਸੀਂ ਕਿਸ ਤਰ੍ਹਾਂ ਦੇ ਜ਼ਿਆਦਾ ਪਸੰਦ ਕਰਦੇ ਹੋ ਪਰ ਵਿਆਹ ਦੇ ਵਿੱਚ ਮੈਡਮ ਵਿਆਹ ਦੇ ਵਿੱਚ ਇਹ ਵੀ ਹੈ ਨਾ ਕਿ ਵਿਆਹ ਵਾਲੇ ਮੌਕੇ ਦੇ ਵਿੱਚ ਸੂਟ ਜਿੰਨਾ ਮਰਜ਼ੀ ਹੋਵੇ ਥੋੜ੍ਹਾ ਜਿਹਾ ਨਾ ਹੈਵੀ ਥੋੜ੍ਹੀ ਲੁਕ ਚੰਗੀ ਲੱਗਦੀ ਹਾਂ ਹਾਂ ਥੋੜ੍ਹਾ ਜਿਹਾ ਵਿਆਹ ਵਾਲੇ ਬੰਦੇ ਨੂੰ ਥੋੜ੍ਹੇ ਬਰਾਈਟ ਕਲਰ ਵੀ ਪਸੰਦ ਆਉਂਦੇ ਆ ਤੁਸੀਂ ਉਸ ਹਿਸਾਬ ਨਾਲ ਦੇਖ ਲਓ ਕਿ ਤੁਹਾਡੀ ਕਿਹੜੀ ਚੋਇਸ ਤਾਂ ਬਰਾਈਟ ਕਲਰ ਜਾਂ ਥੋੜ੍ਹੇ ਜਿਹੇ ਲਾਈਟ ਜਾਂ ਠੀਕ ਠੀਕ ਕਲਰ ਅੱਛਾ ਜੀ ਰਿਸ਼ਤੇਦਾਰਾਂ ਵਾਸਤੇ ਹਾਂਜੀ ਹਾਂਜੀ ਹਾਂਜੀ ਉਹ ਵੀ ਠੀਕ ਆ ਹਾਂ ਫਿਰ ਤੁਸੀਂ ਸਿਲਕ ਦੇ ਸੂਟ ਦੇਖ ਸਕਦੇ ਹੋ ਸਿਲਕ ਦੇ ਤੁਸੀਂ ਵੇਖ ਸਕਦੇ ਹੋ ਜਿਹਦੇ ਵਿੱਚ ਹੈਵੀ ਜਿਹੜੀ ਫਰੰਟ 'ਤੇ ਹੈਵੀ ਅਬੋਰਾਈਡਰੀ ਹੋ ਜਾਏਗੀ ਅਤੇ ਦੁਪੱਟਾ ਜੇ ਹੈਵੀ ਅਬੋਰਾਈਡਰੀ ਅਤੇ ਦੁਪੱਟਾ ਉਹਦੇ ਨਾਲ ਆਸ ਪਾਸ ਸਿਰਫ ਦੁਪੱਟੇ ਦੇ ਪੱਟੀ ਲੱਗੀ ਹੋਵੇਗੀ ਜੇਕਰ ਸੂਟ ਸਿੰਪਲ ਆ ਜੇ ਤਾਂ ਗਲੇ ਦੇ ਉੱਤੇ ਅਬੋਰਾਈਡਰੀ ਹੈ ਤਾਂ ਫਿਰ ਦੁਪੱਟਾ ਉਹਦੇ ਨਾਲ ਹੈਵੀ ਹੋਜੂਗਾ ਇਹ ਅਤੇ ਹੋ ਜਾਂਦੇ ਸਿਲਕ ਦੇ ਸੂਟ ਹੋਰ ਹੁਣ ਤੁਸੀਂ ਦੱਸੋ ਜਿੱਦਾਂ ਵੈਲਵੱਟ ਦੇ ਸਰਦੀਆਂ ਦੇ ਵਿੱਚ ਵੈਲਵਟ ਵਾਲੇ ਮੌਸਮ ਦੇ ਵੀ ਚੱਲ ਜਾਂਦੇ ਵੈਲਵਟ ਅਤੇ ਹੋ ਗਈ ਅਬੋਰਾਈਡਰੀ ਵਾਲੇ ਸੂਟ ਹਾਂ ਪਸ਼ਮੀਨੇ ਦੇ ਹਾਂ ਸ਼ੋਲਾਂ ਵਾਲੇ ਸਟੋਲ ਅੱਜ ਕੱਲ੍ਹ ਨਾਲ ਬਹੁਤ ਸੋਹਣੇ ਆਉਂਦੇ ਮੈਚਿੰਗ ਉਹ ਵੀ ਤੁਸੀਂ ਟਰਾਈ ਕਰ ਸਕਦੇ ਹੋ ਤੁਸੀਂ ਦੇਖ ਲੈਣ ਦੇ ਵਿੱਚ ਤੁਸੀਂ ਉਹ ਦੂਸਰੇ ਸਿਲਕ ਤੋਂ ਇਲਾਵਾ ਤੁਸੀਂ ਹੋਰ ਵੀ ਜਿੱਦਾਂ ਅੱਜ ਕੱਲ੍ਹ ਉਹਦੇ ਆਉਂਦੇ ਆ ਜੇਕਰ ਥੋੜ੍ਹੇ ਜਿਹੇ ਵਧੀਆ 'ਚ ਅਸੀਂ ਕਹਿ ਲਈਏ ਅਤੇ ਜੋਰਜਟ ਅਤੇ ਕੱਪੜਾ ਵੀ ਬਹੁਤ ਪਸੰਦ ਆ ਉਹਦੇ ਵੀ ਤੁਸੀਂ ਟਰਾਈ ਕਰ ਸਕਦੇ ਹੋ ਹੋਰ ਹਾਂਜੀ ਹਾਂਜੀ ਮੈਡਮ ਜਿੱਦਾਂ ਤੁਸੀਂ ਕਹੋਗੇ ਬਸ ਉਸ ਹਾਂ ਨਹੀਂ ਵਧੀਆ ਕੀਤਾ ਤੁਸੀਂ ਹਾਂ ਦਰਅਸਲ ਸੰਡੇ ਨੂੰ ਸਾਡਾ ਆਫ ਹੁੰਦਾ ਵਾ ਅਤੇ ਬਾਕੀ ਤੁਸੀਂ ਸਾਰੇ ਜਿਹੜੇ ਮਰਜ਼ੀ ਵਰਕਿੰਗ ਡੇ ਦੇ ਵਿੱਚ ਤੁਸੀਂ ਆ ਸਕਦੇ ਹੋ ਅਤੇ ਸਵੇਰੇ ਸਾਡੀ ਦੁਕਾਨ ਖੁੱਲ੍ਹ ਜਾਂਦੀ ਹੈ ਨੌਂ ਕੁ ਵਜੇ ਅਤੇ ਰਾਤੀ ਨੌਂ ਵਜੇ ਤੱਕ ਅਸੀਂ ਰਹੀ ਦਾ ਜਿਸ ਤਰ੍ਹਾਂ ਦੀ ਤੁਹਾਨੂੰ ਪਸੰਦ ਹੋਣਗੇ ਤੁਸੀਂ ਜਿਹੜਾ ਕਹੋਗੇ ਉਸ ਹਿਸਾਬ ਦੇ ਨਾਲ ਤੁਸੀਂ ਸਿਲੈਕਟ ਕਰ ਸਕਦੇ ਹੋ ਸੂਟ ਸਾਡੀ ਦੁਕਾਨ ਦਰਅਸਲ ਨਾ ਜਿਦਾਂ ਤੁਸੀਂ ਮੇਨ ਰਾਮਾ ਮੰਡੀ ਪਹੁੰਚੋਗੇ ਰਾਮਾ ਮੰਡੀ ਦੇ ਚੌਂਕ ਤੋਂ ਤੁਸੀਂ ਮੁੜਦੇ ਹੋ ਅਤੇ ਤੁਸੀਂ ਉੱਥੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਸਾਡੀ ਦੁਕਾਨ ਦਾ ਨਾਮ ਲੈ ਕੇ ਨਾ ਸਾਡੀ ਬੜੀ ਪੁਰਾਣੀ ਦੁਕਾਨ ਆ ਉੱਥੇ ਤੁਸੀਂ ਜਿਹਨੂੰ ਮਰਜ਼ੀ ਨਾਮ ਲੈ ਕੇ ਅਤੇ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਨਹੀ ਅਤੇ ਤੁਸੀਂ ਰਾਮਾ ਮੰਡੀ ਪਹੁੰਚ ਕੇ ਤਾਂ ਮੈਨੂੰ ਭਾਵੇਂ ਕਾਲ ਕਰ ਲਈਓ ਅਤੇ ਉੱਥੇ ਤੁਹਾਨੂੰ ਉਸ ਵੇਲੇ ਤੁਹਾਨੂੰ ਗਾਈਡ ਵੀ ਕਰ ਦੇਵਾਂਗੇ ਦੱਸ ਦੇਵਾਂਗੇ ਕਿ ਕਿੱਥੇ ਕਿੱਥੇ ਸਾਡਾ ਉਹ ਰਸਤਾ ਪੈਂਦਾ ਠੀਕ ਹੈ ਜੀ ਬਾਕੀ ਤੁਸੀਂ ਵਿਆਹ ਦੇ ਵਿੱਚ ਨੋਰਮਲ ਜੇ ਤੁਸੀਂ ਇਹ ਤੁਹਾਡੀ ਬੇਟੀ ਨੇ ਆਪਣੇ ਲਾਸਤੇ ਵੀ ਲੈਣੇ ਆ ਤੁਸੀਂ ਤੁਸੀਂ ਉਹ ਵੀ ਲੈ ਸਕਦੇ ਹੋ ਵਿਆਹ ਅਤੇ ਦਾਜ ਦਾ ਅਤੇ ਬਰੀ ਦਾ ਵੀ ਸਾਡੇ ਕੋਲ ਸਾਰਾ ਸਮਾਨ ਮਿਲਦਾ ਨਹੀਂ ਇਹ ਤਾਂ ਬਹੁਤ ਵਧੀਆ ਚੀਜ਼ ਹੈ ਤੁਹਾਡੀ ਗੱਲ ਹਾਂ ਨਹੀਂ ਨਹੀਂ ਉਹ ਤਾਂ ਜਿਆਦਾ ਠੀਕ ਆ ਕਿਉਂਕਿ ਥਾਂ ਥਾਂ ਘੁੰਮਣ ਦਾ ਇੰਨਾ ਟਾਈਮ ਵੀ ਨਹੀਂ ਹੁੰਦਾ ਵਿਆਹ ਦੇ ਵਿੱਚ ਦਿਨ ਵੀ ਘੱਟ ਹੀ ਹੁੰਦੇ ਆ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਵਰਾਇਟੀ ਮਿਲ ਜਾਊਗੀ ਤੁਸੀਂ ਦੇਣ ਲੈਣ ਲਈ ਲੈਣੇ ਉਹ ਵੀ ਮਿਲ ਜਾਣਗੇ ਜੇ ਵਿਆਹ ਵਾਲੀ ਕੁੜੀ ਨੇ ਆਪਣੇ ਲੈਣੇ ਉਹ ਵੀ ਮਿਲ ਜਾਣਗੇ ਠੀਕ ਹੈ ਜੀ ਨਹੀਂ ਜੈਂਟਸ ਅਤੇ ਸਾਡੇ ਕੋਲ ਨੋਰਮਲ ਹੁੰਦੇ ਆ ਬਟ ਜੇ ਤੁਸੀਂ ਕੋਈ ਵਿਆਹ ਵਾਲੇ ਬੇਸਿਕਲੀ ਅਸੀਂ ਕੁੜੀਆਂ ਦਾ ਹੀ ਕੁਛ ਰੱਖਦੇ ਆ ਸਮਾਨ ਜੈਟਸ ਦੇ ਜਿਹੜੇ ਆ ਵਿਆਹ ਵਾਲੇ ਨਹੀਂ ਹੁੰਦੇ ਪਰ ਨੋਰਮਲ ਜਿੱਦਾਂ ਆਮ ਪਾਉਣ ਵਾਲੇ ਰੂਟੀਨ ਦੇ ਕੈਜੁਅਲ ਹੁੰਦੇ ਆ ਵਿਆਹ ਵਾਲੇ ਨਹੀਂ ਅਸੀਂ ਰੱਖਦੇ ਹਾਂ ਕੋਰਟ ਪੈਂਟ ਦਾ ਕੱਪੜਾ ਸਾਡੇ ਕੋਲ ਸਿਰਫ ਰੇਮੈਂਟ ਦਾ ਹੁੰਦਾ ਹੋਰ ਸਾਡੇ ਕੋਲ ਕਿਸੇ ਵੀ ਬਰਾਇਟੀ ਨਹੀਂ ਰੱਖੀ ਰੇਮੈਂਟ ਤੋਂ ਘੱਟ ਰੱਖੀ ਦੀ ਨਹੀਂ ਸਿਰਫ ਕੋਟ ਪੈਂਟ ਦਾ ਕੱਪੜਾ ਦੇਵਾਂਗੇ ਅਨਸਟਿਚਿੰਗ ਸਟਿਚਿੰਗ ਵਾਸਤੇ ਕੁਛ ਨਹੀਂ ਪੈਂਟ ਸ਼ਰਟ ਦਾ ਕੱਪੜਾ ਵੀ ਮਿਲਜੁਗਾ ਹਾਂ ਸਟਿਚ ਕਰਵਾਉਣੀ ਪਉਗੀ ਕੁੜੀਆਂ ਦੇ ਤਾਂ ਸਾਡੇ ਸਾਰੇ ਹੀ ਚੱਲ ਜਾਂਦੇ ਆ ਅਤੇ ਤੁਸੀਂ ਜਦੋਂ ਆਓਗੇ ਉਦੋਂ ਤੁਸੀਂ ਦੇਖ ਲਈਓ ਸਾਰਾ ਕੁਛ ਨਹੀਂ ਅਸੀਂ ਉਹਦਾ ਕੱਪੜਾ ਪ੍ਰੋਵਾਈਡ ਕਰਦੇ ਹਾਂ ਅਸੀਂ ਉਹ ਨਹੀਂ ਕਰਦੇ ਬਰਾਈਡਲ ਦਾ ਰੈਂਟ 'ਤੇ ਨਹੀਂ ਦਿੰਦੇ ਜਿੱਦਾਂ ਕਈ ਦੁਕਾਨਾਂ ਰੈਂਟ 'ਤੇ ਦਿੰਦੇ ਨੇ ਰੈਂਟ ਨਹੀਂ ਅਸੀਂ ਉੱਦਾ ਦਿੰਦੇ ਹਾਂ ਜੇ ਤੁਸੀਂ ਵੈਸੇ ਖਰੀਦਣਾ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ ਕੱਪੜਾ ਲੈ ਕੇ ਸੀ ਉਹ ਦਾ ਸਟਿੱਚ ਵੀ ਤੁਹਾਨੂੰ ਕਰਵਾ ਦੇਵਾਂਗੇ ਠੀਕ ਹੈ ਜੀ ਹਾਂਜੀ ਤੁਸੀਂ ਸਾਨੂੰ ਕਾਲ ਕਰਕੇ ਆਇਓ ਹਾਂ ਹਾਂਜੀ ਹਾਂਜੀ ਤੁਸੀਂ ਹਾਂ ਥੋੜ੍ਹਾ ਅਵੋਇਡ ਕਰੋ ਬਾਰਿਸ਼ ਤੋਂ ਬਾਅਦ ਬਾਕੀ ਤੁਸੀਂ ਜਦੋਂ ਕਹੋਗੇ ਇੱਕ ਵਾਰੀ ਕਾਲ ਕਰਕੇ ਪਹਿਲੋਂ ਆ ਜਾਇਓ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਓਕੇ ਜੀ ਮਿਹਰਬਾਨੀ ਜੀ ਠੀਕ ਹੈ ਓਕੇ ਜੀ ਓਕੇ